ਮੇਰੇ ਆਂਢ ਗੁਆਂਢ ਵਿੱਚ ਕੁਝ ਘਰ ਹੀ ਹੋਮ ਸਟੇਅ ਦੀ ਸਹੂਲਤ ਪ੍ਰਦਾਨ ਕਰਦੇ ਹਨ ਕਿਉਂਕਿ ਇੱਥੇ ਟਾਟਾ ਕੰਨਸਲਟੈਂਸੀ ਸਰਵਿਸਿਸ ਦਾ ਸੈਂਟਰ ਹੈ ਇੱਥੇ ਵਿਦਿਆਰਥੀਆਂ ਦੇ ਗੋਰਮੈਂਟ ਜੋਬ ਲਈ ਪੇਪਰ ਲੀਤੇ ਜਾਂਦੇ ਹਨ ਤਾਂ ਕਰਕੇ ਇੱਥੇ ਬਹੁਤ ਵਿਦਿਆਰਥੀ ਰਾਤ ਰੁਕਦੇ ਹਨ ਘਰਾਂ ਵਿੱਚ ਹੋਮ ਸਟੇਅ ਦੇਣ ਵਾਲਿਆਂ ਲਈ ਇੱਥੇ ਹੀ ਪਹਿਲੀ ਚੁਣੌਤੀ ਆਉਂਦੀ ਹੈ ਉਹਨਾਂ ਨੂੰ ਆਪ ਉਸ ਜਗ੍ਹਾ ਜਾ ਕੇ ਲੋਕਾਂ ਨੂੰ ਬਲਾਉਣਾ ਪੈਂਦਾ ਹੈ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿਉਂਕਿ ਇਹਨਾਂ ਹੋਮ ਸਟੇਅ ਦੀ ਮਸ਼ਹੂਰੀ ਜ਼ਿਆਦਾ ਨਹੀਂ ਹੁੰਦੀ ਲੋਕਾਂ ਨੂੰ ਇਹਨਾਂ ਬਾਰੇ ਜ਼ਿਆਦਾ ਜਾਣੂ ਨਹੀਂ ਹੁੰਦੇ ਹੈਗੇ ਦੂਜੀ ਤਰਫ ਜੋ ਸੈਲਾਨੀ ਹੁੰਦੇ ਹਨ ਘੁੰਮਣ ਲਈ ਆਉਂਦੇ ਹਨ ਉਹ ਜ਼ਿਆਦਾਤਰ ਵਧੀਆ ਹੋਟਲ ਵਿੱਚ ਹੀ ਰਾਤ ਬਤੀਤ ਕਰਨਾ ਚਾਹੁੰਦੇ ਹਨ ਉਹ ਹੋਮ ਸਟੇਅ ਦੇ ਵਿੱਚ ਘੱਟ ਹੀ ਰਹਿੰਦੇ ਹਨ ਇੱਕ ਹੋਰ ਚੁਣੌਤੀ ਹੁੰਦੀ ਹੈ ਇਹਨਾਂ ਲਈ ਸੁਰੱਖਿਆ ਨੂੰ ਲੈ ਕੇ ਲੋਕ ਇਸ ਕਰਕੇ ਹੀ ਹੋਮ ਸਟੇਅ ਵਿੱਚ ਨਹੀਂ ਰਹਿੰਦੇ ਕਿਉਂਕਿ ਉਹਨਾਂ ਨੂੰ ਕਿਸੇ ਅਜਨਬੀ ਘਰ ਵਿੱਚ ਰਹਿਣਾ ਬਹੁਤ ਹੀ ਅਸੁਰੱਖਿਅਤ ਲੱਗਦਾ ਹੈ ਹੋਮ ਸਟੇਅ ਵਾਲਿਆਂ ਲਈ ਕਈ ਹੋਰ ਵੀ ਛੋਟੀਆਂ ਛੋਟੀਆਂ ਚੁਣੌਤੀਆਂ ਹੁੰਦੀਆਂ ਹਨ ਜਿਵੇਂ ਕਿ ਕਈ ਸੁਰੱਖਿਆਵਾਂ ਦੇਣਾ ਜਿਵੇਂ ਹੋ ਗਿਆ ਖਾਣਾ ਵਾਈਫਾਈ ਦੀ ਸਹੂਲਤਾਂ ਇਹ ਉਹ ਨਹੀਂ ਦੇ ਪਾਉਂਦੇ ਜਿਨ੍ਹਾਂ ਕਰਕੇ ਲੋਕ ਹੋਟਲ ਨੂੰ ਜ਼ਿਆਦਾ ਪਸੰਦ ਕਰਦੇ ਹਨ